ਮੈਂ ਖਾਣਾ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੌਂਦੀ ਹਾਂ ਕਿਉਂਕਿ ਅੱਜ ਕਲ੍ਹ ਸਬਜ਼ੀਆਂ ਪੇਸਟੀਸਾਈਡਸ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਕਿ ਮਨੁੱਖੀ ਜੀਵਨ ਦੇ ਲਈ ਬਹੁਤ ਹਾਨੀਕਾਰਕ ਹੈ ਇਸ ਲਈ ਉਹਨਾਂ ਨੂੰ ਧੌਣ ਤੋਂ ਬਾਅਦ ਮੈਂ ਸਾਰੇ ਮਸਾਲੇ ਚੰਗੀ ਤਰ੍ਹਾਂ ਕੱਟ ਕੱਟਦੀ ਹਾਂ ਤਾਂ ਕਿ ਸ ਸਬਜ਼ੀ ਬਣਾਉਣ ਦੇ ਵਕਤ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਅਤੇ ਸਾਰਾ ਸਮਾਨ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਬਿਨ੍ਹਾਂ ਵਿਘਨ ਸਬਜ਼ੀ ਅਤੇ ਖਾਣਾ ਟਾਈਮ 'ਤੇ ਤਿਆਰ ਹੋ ਜਾਵੇ